ਸਰਦੀਆਂ ਦਾ ਮੌਸਮ ਆ ਚੁੱਕਿਆ ਹੈ ਅਸੀਂ ਆਪਣੇ ਘਰ ਦੇ ਵਿੱਚ ਪਨੀ ਦੇਸੀ ਘਿਓ ਤੋਂ ਪੰਜੀਰੀ ਤਿਆਰ ਕਰਨੀ ਹੈ ਪਹਿਲਾਂ ਅਸੀਂ ਘਿਓ ਦੇ ਵਿੱਚ ਮਖਾਣੇ ਭੁੰਨੇ ਅਤੇ ਫਿਰ ਅਸੀਂ ਘਿਓ ਦੇ ਵਿੱਚ ਆਟਾ ਭੁੰਨਿਆ ਉਸ ਤੋਂ ਬਾਅਦ ਅਸੀਂ ਆਟਾ ਭੁੰਨਣ ਤੋਂ ਉਪਰੰਤ ਫਿਰ ਉਹਦੇ ਵਿੱਚ ਜਿਵੇਂ ਕਾਜੂ ਬਦਾਮ ਮਖਾਣੇ ਸੋਗੀ ਅਤੇ ਹੋਰ ਕਈ ਚੀਜ਼ਾਂ ਪਾਈਆਂ ਤਾਂ ਜੋ ਪੰਜੀਰੀ ਦਾ ਸਵਾਦ ਵਧੀਆ ਬਣ ਸਕੇ ਅਤੇ ਉਸਦੇ ਵਿੱਚ ਅਸੀਂ ਖੋਆ ਵੀ ਪਾਇਆ ਜਿਸ ਨਾਲ ਉਹ ਹੋਰ ਟੇਸਟੀ ਬਣ ਸਕੇ ਅਤੇ ਅਸੀਂ ਸਾਰੀਆਂ ਚੀਜ਼ਾਂ ਪਾ ਕੇ ਪੰਜੀਰੀ ਤਿਆਰ ਕੀਤੀ ਅਤੇ ਸਾਰੇ ਹੀ ਪਰਿਵਾਰ ਨੇ ਉਸ ਪ ਪੰਜੀਰੀ ਦਾ ਸਵਾਦ ਦੇਖਿਆ ਤਾਂ ਬਹੁਤ ਹੀ ਵਧੀਆ ਬਣੀ ਹੋਈ ਸੀ ਅਤੇ ਬਹੁਤ ਹੀ ਟੇਸਟੀ ਬਣੀ ਹੋਈ ਸੀ ਸੋ ਸਾਰੇ ਪਰਿਵਾਰ ਨੇ ਉਹ ਪੰਜੀਰੀ ਖਾਧੀ